ਅੱਜ ਮੈਂ ਇਹੋ ਜਿਹੀ ਯਾਦ ਸਾਂਝੀ ਕਰਨਾ ਚਾਹੁੰਦਾ ਹਾਂ ਜਿਸ ਦਿਨ ਮੈਂ ਆਪਣਾ ਫੋਨ ਦਾ ਸਾਰਾ ਡਾਟਾ ਗਵਾ ਚੁੱਕਾ ਸੀ ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਕੀ ਹੋਇਆ ਮੈਂ ਬੇਚੈਨੀ ਨਾਲ ਆਪਣੇ ਫੋਨ ਦੀ ਜਾਂਚ ਕੀਤੀ ਉਮੀਦ ਕੀਤੀ ਕਿ ਇਹ ਸਿਰਫ ਇੱਕ ਤਕਨੀਕੀ ਗੜਬੜ ਹੈ ਪਰ ਫਿਰ ਮੈਨੂੰ ਬਹੁਤ ਨਿਰਾਸ਼ਾ ਅਤੇ ਅਫਸੋਸ ਹੋਇਆ ਕਿਉਂਕਿ ਮੈਂ ਆਪਣੇ ਡਾਟਾ ਦਾ ਸਹੀ ਢੰਗ ਨਾਲ ਬੈਕਅਪ ਨਾ ਲੈਣ ਕਰਕੇ ਆਪਣੀ ਸਾਰੀ ਮਹੱਤਵਪੂਰਨ ਫਾਈਲਾਂ ਫੋਟੋਆਂ ਅਤੇ ਦਸਤਾਵੇਜ਼ ਗੁਮਾ ਚੁੱਕਾ ਸੀ ਮੈਂ ਚਿੰਤਿਤ ਮਹਿਸੂਸ ਕੀਤਾ ਅਤੇ ਸੋਚ ਰਿਹਾ ਸੀ ਕਿ ਮੈਂ ਕਦੇ ਉਹਨਾਂ ਨੂੰ ਮੁੜ ਪ੍ਰਾਪਤ ਕਰ ਸਕਦਾ ਹਾਂ ਕਿ ਨਹੀਂ ਕੁਝ ਸਮੇਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਘਬਰਾਉਣਾ ਬੰਦ ਕਰਨਾ ਚਾਹੀਦਾ ਹੈ ਅਤੇ ਆਪਣੇ ਡਾਟਾ ਨੂੰ ਮੁੜ ਪ੍ਰਾਪਤ ਕਰਨ ਲਈ ਕੋਈ ਨਾ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਹੈ ਫਿਰ ਮੈਂ ਇੰਟਰਨੈਟ ਉੱਤੇ ਕੁਝ ਡਾਟਾ ਰਿਕਵਰੀ ਸੋਫਟਵੇਅਰ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਡਾਟਾ ਰਿਕਵਰੀ ਸੇਵਾ ਤੋਂ ਪੇਸ਼ੇਵਰ ਮਦਦ ਵੀ ਮੰਗੀ ਪਰ ਇਸ ਦਾ ਕੋਈ ਵੀ ਹੱਲ ਨਹੀਂ ਹੋਇਆ ਫਿਰ ਮੈਂ ਸੋਚਿਆ ਕਿ ਆਪਣੇ ਘਾਟੇ ਨੂੰ ਸਵੀਕਾਰ ਕਰਦਾ ਹਾਂ ਅਤੇ ਮੁੜ ਆਪਣੇ ਆਪ ਨੂੰ ਸੰਗਠਿਤ ਕਰਨ ਦੀ ਯੋਜਨਾ ਬਣਾਈ ਇਸ ਤੋਂ ਮੈਂ ਸਬਕ ਲਿਆ ਕਿ ਜੇ ਭਵਿੱਖ ਵਿੱਚ ਇਹਦੇ ਨੁਕਸਾਨ ਤੋਂ ਬੱਚਣਾ ਹੈ ਤਾਂ ਆਟੋਮੈਟਿਕ ਕਲਾਊਡ ਬੈਕਅਪ ਸੈਟ ਅਪ ਕਰਨਾ ਬਹੁਤ ਜ਼ਰੂਰੀ ਹੈ ਜੇ ਮੇਰੀ ਕਦੇ ਸਟੋਰੇਜ ਵੱਧ ਜਾਂਦੀ ਹੈ ਤਾਂ ਮੈਂ ਬਾਹਰੀ ਹਾਰਡ ਡਰਾਈਵ ਜਾਂ ਯੂਐਸਬੀ ਦੀ ਵਰਤੋਂ ਕਰ ਸਕਦਾ ਹਾਂ ਮੇਰਾ ਡਾਟਾ ਗਵਾਉਣਾ ਇੱਕ ਮੁਸ਼ਕਿਲ ਤਜ਼ਰਬਾ ਸੀ ਇਸ ਨੇ ਮੈਨੂੰ ਤਿਆਰੀ ਸੰਗਠਨ ਅਤੇ ਬੈਕਅਪ ਦੀ ਮਹੱਤਤਾ ਬਾਰੇ ਕੀਮਤੀ ਸਬਕ ਸਿਖਾਇਆ